ਰੂਪਨਗਰ ਜ਼ਿਲ੍ਹੇ ਵਿੱਚ ਸਥਾਨਕ ਰਿਹਾਇਸ਼ੀ ਵਿਕਲਪ ਬਹੁਤ ਹਨ ਇਸ ਜ਼ਿਲ੍ਹੇ ਵਿੱਚ ਹਾਊਸਿੰਗ ਮਾਰਕੀਟ ਅਤੇ ਰੀਅਲ ਅਸਟੇਟ ਦਾ ਕੰਮ ਵੀ ਬਹੁਤ ਵਧੀਆ ਚੱਲਦਾ ਹੈ ਜੋ ਛੋਟੇ ਘਰਾਂ ਦਾ ਕਿਰਾਇਆ ਓਹ ਤੁਹਾਨੂੰ ਦੋ ਤੋਂ ਤਿੰਨ ਹਜ਼ਾਰ ਰੁਪਏ ਵਿੱਚ ਘਰ ਮਿਲ ਜਾਂਦਾ ਹੈ ਸਿੱਖਿਆ ਲਈ ਆਉਣ ਵਾਲੇ ਲੋਕਾਂ ਲਈ ਵੀ ਬੱਚਿਆ ਲਈ ਵੀ ਰੋਪੜ ਵਿੱਚ ਬਹੁਤ ਜ਼ਿਆਦਾ ਰਿਹਾਇਸ਼ ਉਪਲਬਧ ਹੈ ਇੱਥੇ ਰੀਅਲ ਅਸਟੇਟ ਅਤੇ ਜੋ ਹਾਊਸ ਵਿਕਲਪ ਹਾਊਸਿੰਗ ਵਿਕਲਪ ਹਨ ਉਹ ਵੀ ਬਹੁਤ ਜ਼ਿਆਦਾ ਹਨ ਅਤੇ ਸੜਕਾਂ ਵੀ ਬਹੁਤ ਸਾਫ਼ ਸੁਥਰੀਆਂ ਹਨ